ਸਤਿ ਸ਼੍ਰੀ ਅਕਾਲ ਜੀ ਤੁਸੀਂ ਐਮਾਜੋਨ ਸਾਈਟ ਤੋਂ ਗੱਲ ਕਰਦੇ ਆ ਹਾਂਜੀ ਮੈਂ ਰਾਜਨਦੀਪ ਕੌਰ ਫਤਿਹਗੜ੍ਹ ਸਾਹਿਬ ਤੋਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੈਂ ਜੀ ਇੱਕ ਹਫਤਾ ਪਹਿਲਾਂ ਨਾ ਔਡਰ ਦਿੱਤਾ ਸੀ ਕੁੜਤੀ ਦਾ ਜਿਹੜੀ ਕੁੜਤੀ ਸੀਗੀ ਨਾ ਉਹਦੇ ਵਿੱਚ ਮੈਨੂੰ ਕੁਛ ਬਹੁਤੀਆਂ ਖੂਬੀਆਂ ਪਸੰਦ ਨਹੀਂ ਆਈਆਂ ਉਹਦੀਆਂ ਉਹ 'ਚ ਕਮੀਆਂ ਬਹੁਤ ਸੀਗੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਜਿਵੇਂ ਆਪਾਂ ਫੋਨ 'ਤੇ ਦੇਖੀਏ ਜੀ ਕੁੜਤੀ ਦਾ ਕਲਰ ਰੰਗ ਆ ਜਿਹੜਾ ਉਹ ਬਿਲਕੁਲ ਵੀ ਚੰਗਾ ਨਹੀਂ ਆ ਫੋਨ 'ਤੇ ਤਾਂ ਬੜਾ ਵਧੀਆ ਲੱਗ ਰਿਹਾ ਸੀਗਾ ਦੇਖਣ ਨੂੰ ਪਰ ਇੱਥੇ ਆ ਕੇ ਜਦੋਂ ਦੇਖਿਆ ਉਹ ਬਿਲਕੁਲ ਹੀ ਡੱਲ ਨਜ਼ਰ ਆ ਰਿਹਾ ਸੈਕਿੰਡਲੀ ਜਿਹੜਾ ਕੱਪੜਾ ਸੀ ਆਪਣਾ ਨਾ ਕੱਪੜਾ ਲਿਖਿਆ ਤੁਸੀਂ ਉਹਦੇ 'ਤੇ ਹੋਇਆ ਸੀ ਪਿਓਰ ਕੋਟਨ ਪਰ ਜਦ ਕਿ ਉਹ ਕੱਪੜਾ ਨਾ ਕੋਟਨ ਦਾ ਨਹੀਂ ਜੀ ਉਹ ਮਿਕਸ ਹੈਗਾ ਕੱਪੜਾ ਅਤੇ ਤੁਸੀਂ ਉਹਦੇ ਚਾਰਜ ਵੀ ਸਾਡੇ ਕੋਲੋਂ ਵਾਧੂ ਵਸੂਲੇ ਨੇ ਅਤੇ ਨੰਬਰ ਦੋ 'ਤੇ ਜਿਹੜਾ ਤੁਸੀਂ ਸਾਨੂੰ ਔਡਰ ਭੇਜਿਆ ਉਹ ਵੈਸੇ ਵੀ ਪੰਜ ਦਿਨ ਦੇਰੀ ਨਾਲ ਟਾਈਮ ਤੋਂ ਲੇਟ ਆਇਆ ਹੁਣ ਅਸੀਂ ਤਾਂ ਉਹ ਕੁੜਤੀ ਔਡਰ ਕੀਤੀ ਸੀਗੀ ਵੀ ਚਲੋ ਹੈ ਨਾ ਉਹ ਪਾ ਕੇ ਕੋਈ ਓਕੇਜ਼ਨ 'ਤੇ ਜਾਣਾ ਸੀਗਾ ਵੀ ਉਹ ਅਸੀਂ ਆਪਣਾ ਵਧੀਆ ਤਰੀਕੇ ਨਾਲ ਅਟੈਂਡ ਕਰ ਸਕੀਏ ਪਰ ਹੁਣ ਸਾਨੂੰ ਚੰਗਾ ਨਹੀਂ ਲੱਗਿਆ ਵੀ ਇੱਕ ਤਾਂ ਉਹ ਇੰਨੀ ਲੇਟ ਆਇਆ ਨੰਬਰ ਦੋ 'ਤੇ ਵੀ ਜਿਵੇਂ ਨਾ ਤਾਂ ਉਹਦਾ ਕੱਪੜਾ ਵਧੀਆ ਨਾ ਹੀ ਉਹਦਾ ਰੰਗ ਵਧੀਆ ਅਤੇ ਜਿਹੜਾ ਤੁਸੀਂ ਡਿਲੀਵਰੀ ਲੜਕਾ ਭੇਜਿਆ ਵੀ ਸੀਗਾ ਸਾਡੇ ਕੋਲ ਉਹਨੇ ਸਾਡੇ ਕੋਲੋਂ ਵਾਧੂ ਚਾਰਜ ਦੀ ਮੰਗ ਕੀਤੀ ਸੀਗੀ ਵੀ ਜਦ ਕਿ ਤੁਸੀਂ ਉਹਦੇ ਵਿੱਚ ਤਾਂ ਕੁਛ ਐਵੇਂ ਦਾ ਲਿਖਿਆ ਹੀ ਨਹੀਂ ਸੀ ਹੋਇਆ ਸਾਨੂੰ ਇਸ ਕਰਕੇ ਮੈਨੂੰ ਤਾਂ ਇਹ ਤੁਹਾਡਾ ਕੁੜਤਾ ਪਸੰਦ ਨਹੀਂ ਆਇਆ ਕਿਰਪਾ ਕਰਕੇ ਤੁਸੀਂ ਨੈਕਸਟ ਟਾਈਮ ਤੋਂ ਫੋਨ 'ਤੇ ਸਿਰਫ ਆਪਣਾ ਉਹੀ ਲਿਖਿਆ ਕਰੋ ਜੋ ਤੁਸੀਂ ਵਧੀਆ ਕੁਆਲਿਟੀ ਆ ਜਿਹੜੀ ਦੇ ਸਕੋ ਧੰਨਵਾਦ